ਮੇਰਾ ਯੋਗਾ ਅਭਿਆਸ ਸਮੇਂ ਦੇ ਨਾਲ ਮਹੱਤਵਪੂਰਨ ਤੌਰ 'ਤੇ ਵਿਕਸਿਤ ਹੋਇਆ ਹੈ ਵਿਅਕਤੀਗਤ ਵਿਕਾਸ ਅਤੇ ਅਨੁਸ਼ਾਸਨ ਦੀ ਡੂੰਘੀ ਸਮਝ ਦੋਵਾਂ ਨੂੰ ਦਰਸਾਉਂਦਾ ਹੈ ਸ਼ੁਰੂ ਵਿੱਚ ਮੈਂ ਮੁੱਖ ਤੌਰ 'ਤੇ ਸਰੀਰਕ ਪਹਿਲੂਆਂ 'ਤੇ ਧਿਆਨ ਕੇਂਦਰਿਤ ਕੀਤਾ ਜਿਵੇਂ ਕਿ ਆਸਨਾ ਵਿੱਚ ਮੁਹਾਰਤ ਹਾਸਲ ਕਰਨਾ ਅਤੇ ਲਚਕਤਾ ਵਿੱਚ ਸੁਧਾਰ ਕਰਨਾ ਜਿਵੇਂ ਕਿ ਮੈਂ ਜਾਰੀ ਰੱਖਿਆ ਮੈਂ ਸਾਹ ਦੇ ਨਿਰੰਤਰ ਅਤੇ ਸਾਵਧਾਨੀ ਦੀ ਮਹੱਤਤਾ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਤੱਤਾਂ ਨੂੰ ਜੋੜ ਕੇ ਮੇਰੇ ਅਭਿਆਸ ਨੂੰ ਸਿਰਫ਼ ਸਰੀਰਕ ਲਾਭਾਂ ਤੋਂ ਪਰੇ ਵਧਾ ਦਿੱਤਾ ਸਾਲਾਂ ਦੌਰਾਨ ਮੈਂ ਯੋਗਾ ਦੀਆਂ ਦਾਰਸ਼ਨਿਕ ਸਿੱਖਿਆਵਾਂ ਗੈਰ ਲਗਾਵ ਸਵੈ ਦਿਆ ਅਤੇ ਦਿਮਾਗਿਤਾ ਵਰਗੀਆਂ ਧਾਰਨਾਵਾਂ ਦੀ ਪੜਚੋਲ ਕੀਤੀ ਹੈ ਜਿਸ ਨੇ ਮੇਰੇ ਅਭਿਆਸ ਅਤੇ ਰੋਜ਼ਾਨਾ ਜੀਵਨ ਨੂੰ ਅਮੀਰ ਬਣਾਇਆ ਹੈ ਇੱਕ ਸ਼ੁੱਧ ਸਰੀਰਕ ਫੋਕਸ ਤੋਂ ਇੱਕ ਬਥੇਰੇ ਸੰਪੂਰਨ ਪਹੁੰਚ ਵੱਲ ਇਹ ਤਬਦੀਲੀ ਬਥੇਰੇ ਮਾਨਸਿਕ ਸਪਸ਼ਟਾਂ ਭਾਵਨਾਤਮਕ ਸੰਤੁਲਨ ਅਤੇ ਅੰਦਰੂਨੀ ਸ਼ਾਂਤੀ ਵੱਲ ਲੈ ਗਈ ਹੈ ਇਸ ਤੋਂ ਇਲਾਵਾ ਮੈਂ ਧਿਆਨ ਅਤੇ ਬਹਾਲੀ ਦੀਆਂ ਤਕਨੀਕਾਂ ਨੂੰ ਸ਼ਾਮਲ ਕਰ ਦੇ ਹੋਏ ਇੱਕ ਬਥੇਰੇ ਇੱਕ ਸਾਲ ਅਤੇ ਵਿਭਿੰਨ ਅਭਿਆਸ ਨੂੰ ਅਪਣਾ ਲਿਆ ਹੈ ਜੋ ਸਮੁੱਚੀ ਤੰਦਰੁਸਤੀ ਦਾ ਸਮਰਥਨ ਕਰਦੇ ਹਨ ਇਸ ਵਿਕਾਸ ਨੇ ਯੋਗਾ ਨੂੰ ਸਿਰਫ਼ ਕਸਰਤ ਦੀ ਰੂਟੀਨ ਤੋਂ ਨਿੱਜੀ ਵਿਕਾਸ ਅਤੇ ਸਵੈ ਖੋਜ ਲਈ ਇੱਕ ਡੂੰਘੇ ਸੰਦ ਵਿੱਚ ਬਦਲ ਦਿੱਤਾ ਹੈ ਜਿਸ ਨਾਲ ਮੇਰੇ ਆਪਣੇ ਅਤੇ ਮੇਰੇ ਆਲੇ ਦੁਆਲੇ ਦੀ ਦੁਨੀਆ ਨਾਲ ਮੇਰਾ ਸਬੰਧ ਡੂੰਘਾ ਹੋਇਆ ਹੈ